ਤੁਸੀਂ ਆਪਣੇ ਦੁਆਰਾ ਕੀਤੇ ਗਏ ਚਰਿੱਤਰਾਂ ਨੂੰ ਕਿਵੇਂ ਬਚਾ ਸਕਦੇ ਹੋ ਜਿਵੇਂ ਕਿ ਪੇਪਰ ਨੂੰ ਵਧੀਆ ਢੰਗ ਨਾਲ ਸਾਫ਼ ਸੁਥਰੀ ਜਗ੍ਹਾ ਕਿਸੇ ਵੀ ਫਾਈਲ ਦੇ ਵਿੱਚ ਰੱਖ ਕੇ ਬਚਾ ਸਕਦੇ ਹਾਂ ਜਾਂ ਉਸ ਪੇਪਰ ਨੂੰ ਬਿਨਾਂ ਫੋਲਡ ਕੀਤੇ ਕਿਸੇ ਵੀ ਸਿੱਧੀ ਕੋਪੀ ਦੇ ਵਿੱਚ ਰੱਖ ਕੇ ਬਚਾ ਸਕਦੇ ਹਾਂ ਪੇਪਰ ਦੇ ਉੱਪਰ ਲੈਮੀਨੇਸ਼ਨ ਕਰਕੇ ਵੀ ਉਸਨੂੰ ਕਾਫ਼ੀ ਦੇਰ ਤੱਕ ਬਚਾਇਆ ਸਕਦਾ ਹੈ ਉਹ ਪੇਪਰ ਨੂੰ ਕਿਸੇ ਵੀ ਸੇਫ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ ਜਿਵੇਂ ਕਿ ਡਰੋਰ ਵਗੈਰਾ ਦੇ ਵਿੱਚ ਜਾਂ ਕਿਸੇ ਫਾਈਲ ਦੇ ਵਿੱਚ ਜਾਂ ਕਿਸੇ ਕੋਪੀ ਦੇ ਵਿੱਚ ਰੱਖ ਕੇ ਉਸ ਪੇਪਰ ਨੂੰ ਬਚਾਇਆ ਜਾ ਸਕਦਾ ਹੈ ਜਿਸ ਨਾਲ ਬਾਰ ਬਾਰ ਲੈਮੀਨੇਸ਼ਨ ਕਰਨ ਤੇ ਪੇਪਰ ਦਾ ਬਹੁਤ ਬਚਾਅ ਹੁੰਦਾ ਹੈ ਜਿਸ ਨਾਲ ਉਸਨੂੰ ਬਾਰ ਬਾਰ ਗੰਦੇ ਹੱਥ ਨਹੀਂ ਲੱਗਦੇ ਅਤੇ ਉਹ ਕਾਫ਼ੀ ਦੇਰ ਤੱਕ ਸਹੀ ਸਲਾਮਤ ਅਤੇ ਸੁਰੱਖਿਤ ਰਹਿੰਦਾ ਹੈ ਜਿਸ ਕਾਰਨ ਉਹ ਪੇਪਰ ਨੂੰ ਜਲਦੀ ਫਟਨ ਵੀ ਨਹੀਂ ਸਕਦਾ ਅਤੇ ਨਾ ਗੰਦਾ ਹੋ ਸਕਦਾ ਅਤੇ ਨਾ ਉਸ ਉੱਪਰ ਲਿਖਿਆ ਪ੍ਰਿੰਟ ਖਤਮ ਹੋ ਸਕਦਾ